ਚਿੱਤਰਕਾਰੀ ਕਰਨ ਲਈ ਸਭ ਤੋਂ ਪਹਿਲਾਂ ਗਿਆਨ ਜ਼ਰੂਰੀ ਹੁੰਦਾ ਹੈ ਜੋ ਕਿ ਆਮ ਲੋਕਾਂ ਕੋਲ਼ ਨਹੀਂ ਹੁੰਦਾ ਇਹ ਇਸ ਤਰ੍ਹਾਂ ਜਦੋਂ ਜੋ ਬੰਦਾ ਪਹਿਲੀ ਵਾਰ ਚਿੱਤਰਕਾਰੀ ਕਰਦਾ ਹੈ ਬਿਨਾਂ ਗਿਆਨ ਤੋਂ ਉਹ ਕਾਫੀ ਜ਼ਿਆਦਾ ਗਲਤੀਆਂ ਕਰਦਾ ਹੈ ਪਰ ਚਿੱਤਰਕਾਰੀ ਕਰਨ ਤੋਂ ਪਹਿਲਾਂ ਚਿੱਤਰਕਾਰੀ ਦੇ ਨਿਯਮ ਜਿਹਦੇ ਵਿੱਚ ਚਿੱਤਰਕਾਰੀ ਦਾ ਇੱਕ ਪ੍ਰੋਪਰ ਵਾਤਾਵਰਨ ਅਤੇ ਉਹਦੀ ਪ੍ਰੈਕਟਿਸ ਹੋਣੀ ਜ਼ਰੂਰੀ ਹੈ ਚਿੱਤਰਕਾਰੀ ਲਈ ਕਲਰ ਜਾਂ ਜੋ ਕਲਰ ਸਲੈਕਸ਼ਨ ਹੈ ਜੋ ਇੱਕ ਪੇਪਰ ਕੁਆਲਿਟੀ ਹੈ ਤਾਂ ਉਹ ਵੀ ਬੜੀ ਮੈਟਰ ਕਰਦੀ ਹੈ ਚਿੱਤਰਕਾਰੀ ਕਰਨ ਵਿੱਚ ਬੰਦੇ ਦਾ ਜੋ ਸੁਭਾਅ ਹੈ ਉਹ ਬਿਲਕੁਲ ਸ਼ਾਂਤ ਹੋਣਾ ਚਾਹੀਦਾ ਅਤੇ ਬੰਦਾ ਸ਼ਾਂਤ ਮਾਹੌਲ ਵਿੱਚ ਬੈਠ ਕੇ ਹੀ ਚਿੱਤਰਕਾਰੀ ਕੀਤੀ ਜਾ ਸਕਦੀ ਹੈ ਕਿਤੇ ਜਿਆਦਾ ਆਵਾਜ਼ਾਂ ਜ਼ਿਆਦਾ ਹਾਰਨ ਵਗੈਰਾ ਵਿੱਚ ਨਹੀਂ ਬੰਦਾ ਚਿੱਤਰਕਾਰੀ ਕਰ ਸਕਦਾ